ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਨਿੱਤ ਜੀਵਨ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਉਹਨਾਂ ਵਿੱਚੋਂ ਸ਼ਾਇਦ ਹੀ ਕੋਈ ਅਜਿਹੀ ਹੋਵੇ ਜਿਸਦੇ ਪੈਦਾ ਹੋਣ ਵਿੱਚ ਵਿਗਿਆਨ ਸਹਾਇਕ ਨਾ ਹੋਵੇ ਜ਼ਰਾ ਝਾਤੀ ਮਾਰੀਏ ਤਾਂ ਪੈੱਨ ਪੁਸਤਕ ਕੱਪੜੇ ਬਿਜਲੀ ਅਜਵਾਏ ਦੇ ਸਾਧਨ ਦਵਾਈਆਂ ਮਨਰੰਜਨ ਸਾਰਿਆਂ ਵਿੱਚ ਵਿਗਿਆਨ ਦਾ ਵਰਦਾਨ ਹਨ ਇਸ ਲਈ ਵਿਗਿਆਨ ਹਰ ਇੱਕ ਚੀਜ਼ ਨਾਲ ਜੁੜ ਗਿਆ ਹੈ